ਹੈਲੋ ਹੈਲੋ ਹਾਂਜੀ ਹਾਂ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਪਹੁੰਚ ਗਏ ਪਹੁੰਚ ਗਏ ਹੋਸਟਲ ਜੀ ਹਾਂਜੀ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਜੀ ਕਮਰਾ ਬਹੁਤ ਵਧੀਆ ਹਾਂ ਬਹੁਤ ਵਧੀਆ ਬਹੁਤ ਵਧੀਆ ਬਸ ਜੀ ਕਮਰਾ ਠੀਕ ਠਾਕ ਵੱਡਾ ਆ ਅਤੇ ਦੋ ਬੈੱਡ ਲੱਗੇ ਆ ਇੱਕ ਨਾਲ ਕਲਾਸਮੇਟ ਇੱਕ ਮੇਰੇ ਨਾਲ ਇੱਕ ਉਹਦਾ ਅਤੇ ਇੱਕ ਮੇਰਾ ਹਾਂਜੀ ਹਾਂਜੀ ਸਟੱਡੀ ਰੂਮ ਵਗੈਰਾ ਵੀ ਹੈਗਾ ਇੱਥੇ ਤੇ ਹਾਂਜੀ ਹਾਂਜੀ ਹਾਂਜੀ ਰੋਟੀ ਪਾਣੀ ਬਹੁਤ ਵਧੀਆ ਬਹੁਤ ਵਧੀਆ ਜੀ ਹਾਂ ਸਫਾਈ ਸਫਾਈ ਸਫੂਈ ਸਭ ਕੁਛ ਬਹੁਤ ਵਧੀਆ ਜੀ ਜਿਨ ਹਾਂਜੀ ਹਾਂ ਨਹੀਂ ਪੱਖਾ ਪੱਖੇ ਲੱਗੇ ਏਸ ਏਸ ਏ ਸੀ ਵੀ ਲੱਗਿਆ ਹੋਇਆ ਜੀ ਹਾਂਜੀ ਹਾਂਜੀ ਏ ਸੀ ਵੀ ਹਾਂਜੀ ਹਾਂਜੀ ਹਾਂਜੀ ਜਿੰਨੇ ਕੁ ਪੈਸੇ ਅਸੀਂ ਦਿੱਤੇ ਤੇ ਆ ਸਾਨੂੰ ਫੈਸਿਲਿਟੀ ਪੂਰੀ ਆ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਵੈਸੇ ਵੀ ਮੇਰੀ ਕਲਾਸ ਦਾ ਟਾਈਮ ਆ ਫਓਨ ਉਹ ਵੈੱਲ ਵੱਜ ਗਈ ਆ ਨਾ ਚੱਲਿਆ ਜੀ ਮੈਂ ਜੀ ਤੇ ਓਕੇ